ਮੈਂ ਲੰਬੇ ਬਾਈਕ ਯਾਤਰਾ ਵਿਚ ਕੁਝ ਜ਼ਰੂਰੀ ਸਮਾਨ ਆਪ ਦੇ ਨਾਲ ਜੋ ਕੈਰੀ ਕਰਨਾ ਕਰਦੀ ਹਾਂ ਮੈਂ ਅਕਸਰ ਹੀ ਬਾਈਕਿੰਗ ਅਤੇ ਟੂਰ ਵਗੈਰਾ ਕਰਦੀ ਰਹਿੰਦੀ ਹਾਂ ਜਿਸ ਵਿੱਚ ਮੈਂ ਆਪਣਾ ਜ਼ਰੂਰੀ ਸਮਾਨ ਖਾਣ ਪੀਣ ਦਾ ਬੇਸਿਕ ਨਸੈਸਰੀ ਜਿਵੇਂ ਬਰਸ਼ ਜੋ ਕਿ ਕਈ ਵਾਰ ਸਾਨੂੰ ਇਜ਼ੀਲੀ ਅਵੇਲੇਬਲ ਨਹੀਂ ਹੁੰਦਾ ਸੋਪ ਔਇਲ ਕੌਮ ਟਾਵਲ ਕਲੋਥ ਅਤੇ ਕੁਛ ਹਾਈਜੀਨ ਲਈ ਅ ਸੈਨੇਟਾਈਜ਼ਰ ਫੂਡ ਇਹ ਸਾਰਾ ਕੁਛ ਮੈਂ ਆਪਣੇ ਨਾਲ ਕੈਰੀ ਕਰਦੀ ਜੋ ਕਿ ਸਾਨੂੰ ਲੰਬੀ ਯਾਤਰਾ ਵਿੱਚ ਬਹੁਤ ਜ਼ਿਆਦਾ ਸਹਾਈ ਵੀ ਹੁੰਦਾ ਇਹ ਕੁਝ ਮਹੱਤਵਪੂਰਨ ਚੀਜ਼ਾਂ ਅਤੇ ਖ਼ਾਸ ਚੀਜ਼ਾਂ ਹਨ ਜੋ ਕਿ ਸਾਨੂੰ ਆਪਣੇ ਨਾਲ ਹਮੇਸ਼ਾ ਕੈਰੀ ਕਰਕੇ ਲੈ ਕੇ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਅਸੀਂ ਆਸਾਨੀ ਨਾਲ ਅਸੀਂ ਕਿਤੇ ਵੀ ਟੂਰ ਕਰ ਸਕਦੇ ਹਾਂ